ਓਡੀਓ ਵਿਜ਼ੂਅਲ ਦੀ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਪ੍ਰੋਜੈਕਟਰ ਲੈਂਪ ਆ ਜਾਂਦਾ ਹੈ ਅਤੇ ਪ੍ਰੋਜੈਕਟਰ ਸਕ੍ਰੀਨ ਆ ਜਾਂਦੀ ਹੈ ਅਤੇ ਅਸੀਂ ਇੱਕ ਪੈਨ ਡਰਾਈਵ ਨਾਲ ਐਨੀਮੇਸ਼ਨ ਵੀਡੀਓਜ਼ ਦਿਖਾ ਕੇ ਅਤੇ ਇਹ ਅਸੀਂ ਉਹਨਾਂ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਉਹਨਾਂ ਨੂੰ ਉਹਨਾਂ ਦੇ ਵਿਸ਼ੇ 'ਤੇ ਜੋ ਵੀ ਉਹ ਵਿਸ਼ਾ ਚੱਲ ਰਿਹਾ ਉਹ ਪੜ੍ਹ ਰਹੇ ਹਨ ਉਹਨਾਂ ਨੂੰ ਐਨੀਵੇਸ਼ਨ ਵੀਡੀਓ ਨਾਲ ਅਸੀਂ ਉਹਨਾਂ ਨੂੰ ਦਿਖਾ ਕੇ ਬਹੁਤ ਹੀ ਘੱਟ ਸਮੇਂ ਵਿੱਚ ਉਹਨਾਂ ਨੂੰ ਸਮਝਾ ਸਕਦੇ ਹਾਂ ਸਕੂਲਾਂ ਵਿੱਚ ਇਹ ਚੀਜ਼ਾਂ ਦੀ ਬਹੁਤ ਕਮੀ ਹੈ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਕੱਲ੍ਹ ਪੜ੍ਹਾਈ ਬੜੀ ਮਾੜੀ ਚੱਲਦੀ ਹੈ ਜਿਹੜੇ ਕਿ ਪਿੰਡਾਂ ਵਿੱਚ ਸਕੂਲ ਹੁੰਦੇ ਹਨ ਉਹਨਾਂ ਦੇ ਵਿੱਚ ਓਡੀਓ ਵਿਜ਼ੂਅਲ ਏਡਸ ਇਹ ਬਹੁਤ ਜ਼ਿਆਦਾ ਉਹਨਾਂ ਦੀ ਕਮੀ ਹੈ ਅਤੇ ਉਹ ਇਹਨਾਂ ਤੋਂ ਵਾਂਝੇ ਵੀ ਰਹਿ ਜਾਂਦੇ ਹਨ ਇਹਨਾਂ ਚੀਜ਼ਾਂ ਦੇ ਨਾਲ ਓਡੀਓ ਅਤੇ ਵੀਡੀਓ ਜਿਹੜੀ ਮੈਂ ਗੱਲ ਕੀਤੀ ਹੈ ਇਹ ਪੜ੍ਹਾਈ ਦੇ ਵਿੱਚ ਬਹੁਤ ਹੀ ਕਾਰਗਰ ਸਿੱਧ ਹੁੰਦੀਆਂ ਹਨ ਅਤੇ ਬੱਚਿਆਂ ਨੂੰ ਐਨੀਮੇਸ਼ਨ ਦਿਖਾ ਕੇ ਖਾਸ ਕਰਕੇ ਛੋਟੇ ਬੱਚੇ ਜਿਹੜੇ ਕਿ ਬਹੁਤ ਪ੍ਰਾਈਮਰੀ ਸਕੂਲਾਂ ਪ੍ਰਾਈਮਰੀ ਕਲਾਸਾਂ 'ਚ ਪੜ੍ਹਦੇ ਹਨ ਜਿਹੜੇ ਕਿ ਪੰਜਵੀਂ ਤੋਂ ਥੱਲੇ ਥੱਲੇ ਹਨ ਉਹਨਾਂ ਦੀ ਦਿਮਾਗ ਵਿੱਚ ਇਹ ਬਹੁਤ ਛੇਤੀ ਪੈਂਦੀ ਹੈ ਐਨੀਮੇਸ਼ਨ ਰਾਹੀਂ ਚੀਜ਼ਾਂ